ਨੌਜਵਾਨ ਪੀੜ੍ਹੀ ਨੂੰ ਖਬਰਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਖਬਰਾਂ ਰਾਹੀਂ ਹੀ ਅੱਜ ਕੱਲ੍ਹ ਜੋ ਸਾਨੂੰ ਚੰਗੇ ਮਾੜੇ ਦਾ ਚੰਗੇ ਮਾੜੇ ਕੰਮਾਂ ਦਾ ਲੇਖਾ ਜੋਖਾ ਦਰਸਾਇਆ ਜਾਂਦਾ ਜੋ ਕਿ ਕਈ ਵਾਰੀ ਸਹੀ ਹੁੰਦਾ ਅਤੇ ਕਈ ਵਾਰੀ ਇਹ ਚੀਜ਼ਾਂ ਗਲਤ ਵੀ ਹੁੰਦੀਆਂ ਤਾਂ ਅਤੇ ਸਾਨੂੰ ਇਹਦੀ ਪੂਰੀ ਘੋਖ ਪੜਤਾਲ ਕਰਨੀ ਚਾਹੀਦੀ ਹੈ ਇਹ ਕਈ ਖਬਰਾਂ ਮਨਘੜਤ ਹੁੰਦੀਆਂ ਨੇਗੀਆ ਜੋ ਕਿ ਸਾਨੂੰ ਇਹਦੀ ਪੜਚੋਲ ਕਰਨੀ ਚਾਹੀਦੀ ਹੈ ਗਲਤ ਖਬਰਾਂ 'ਤੇ ਅਸਰ ਨਹੀਂ ਕਰਨਾ ਚਾਹੀਦਾ ਕਈ ਖਬਰਾਂ ਇਹੀਆਂ ਜਿਹੀਆਂ ਹੁੰਦੀਆਂ ਨੇਗੀਆਂ ਕਿ ਸਾਨੂੰ ਬਹੁਤ ਹੀ ਉਤਸ਼ਾਹਿਤ ਕਰਦੀਆਂ ਨੇ ਅਤੇ ਫਾਇਦਾ ਦਿੰਦੀਆਂ ਨੇਗੀਆਂ ਕਿ ਸਾਨੂੰ ਇਹਨਾਂ ਦਾ ਖਬਰਾਂ ਦਾ ਬਹੁਤ ਹੀ ਚੰਗੀਆਂ ਖਬਰਾਂ ਦਾ ਬਹੁਤ ਹੀ ਫਾਇਦਾ ਹੁੰਦਾ ਹੈਗਾ ਧੰਨਵਾਦ